ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਡਰਾਇੰਗ ਬਣਾਈ ਸੀ ਮੈਨੂੰ ਕੁਝ ਸ਼ੁਰੂ ਤੋਂ ਹੀ ਡਰਾਇੰਗ ਕਰਨ ਦਾ ਬਹੁਤ ਸ਼ੌਂਕ ਸੀ ਅਤੇ ਮਨ ਹੀ ਮਨ ਮੈਂ ਇੰਟਰਨੈੱਟ ਤੋਂ ਇੱਕ ਤਸਵੀਰ ਡਾਊਨਲੋਡ ਕੀਤੀ ਅਤੇ ਇੱਕ ਚਾਰਟ ਲੈ ਕੇ ਰੱਖ ਲਿਆ ਅਤੇ ਮੈਂ ਜਦੋਂ ਉਸ ਨੂੰ ਘੰਟੇ ਬਾਦ ਬਣਾਉਣ ਲੱਗੀ ਤਾਂ ਉਸ ਓਹ ਦੇਖਣ ਨੂੰ ਤਾਂ ਆਮ ਜਿਹੀ ਲੱਗਦੀ ਸੀ ਪਰ ਜਦੋਂ ਬਣਾ ਕੇ ਤਿਆਰ ਹੋਈ ਅਤੇ ਮੈਂ ਉਸਨੂੰ ਧਿਆਨ ਨਾਲ ਦੇਖਿਆ ਉਹ ਰੋਟੀ ਦਾ ਟੁਕੜਾ ਸੀ ਜਿਸ 'ਤੇ ਗਰੀਬ ਬੱਚੇ ਛੋਟੇ ਛੋਟੇ ਬੈਠ ਬੈਠੇ ਦਿਖਾਈ ਦੇ ਰਹੇ ਸਨ ਉਹ ਤਸਵੀਰ ਅੱਜ ਕੱਲ੍ਹ ਦੀ ਅਸਲੀਅਤ ਨੂੰ ਦਰਸਾਉਂਦੀ ਹੈ ਨਜ਼ਰ ਆਉਂਦੀ ਹੈ ਅਤੇ ਉਸ ਦਾ ਮੇਰੇ ਮਨ 'ਤੇ ਡੂੰਘਾ ਅਸਰ ਪਿਆ ਹੈ